ਸਤਿ ਸ਼੍ਰੀ ਅਕਾਲ ਜੀ ਆ ਤੁਸੀਂ ਬਰਨਾਲਾ ਕਲੱਬ ਦੇ ਕੋਆਰਡੀਨੇਟਰ ਬੋਲਦੇ ਹੋ ਜੀ ਓ ਅਸੀਂ ਐਂ ਪੁੱਛਣਾ ਸੀ ਜੀ ਵੀ ਸਾਡੇ ਦੋ ਬੱਚੇ ਨੇਗੇ ਇੱਕ ਬੇਟਾ ਅਤੇ ਇੱਕ ਬੇਟੀ ਉਹ ਨਾ ਵੀ ਕੋਈ ਐਕਟੀਵਿਟੀ ਨਾ ਕਰਦੇ ਨਹੀਂ ਹੈਗੇ ਮਤਲਬ ਸਾਰਾ ਦਿਨ ਘਰ ਫੋਨ ਹੀ ਦੇਖੀ ਜਾਂਦੇ ਰਹਿੰਦੇ ਹੈਗੇ ਵੈਸੇ ਉਹਨਾਂ ਨੂੰ ਮਤਲਬ ਡਾਂਸ ਵਗੈਰਾ ਖੇਡਣ ਵਗੈਰਾ ਦਾ ਸ਼ੌਂਕ ਹੈਗਾ ਪਰ ਉਹ ਨਾ ਖੇਡਣ ਬਾਹਰ ਜਾਂਦੇ ਨਹੀਂ ਹੈਗੇ ਗੇ ਵੀ ਅਗਰ ਤੁਹਾਡੇ ਕੋਲ ਇੱਥੇ ਕੋਈ ਸਹੂਲਤਾਂ ਵਗੈਰਾ ਹੈਗੀਆਂ ਨੇਗੀਆਂ ਵੀ ਤੁਹਾਡੇ ਜਿਹੜੇ ਸਹੂਲਤਾਂ ਨੇ ਉਹਨਾਂ 'ਚ ਤੁਸੀਂ ਸਾਡੀ ਕੋਈ ਸਹਾਇਤਾ ਕਰ ਸਕਦੇ ਹੋ ਜੀ ਹਾਂਜੀ ਹਾਂਜੀ ਅੱਛਾ ਫਿਰ ਮੈਂ ਮਤਲਬ ਸਾਡੀ ਜਿਹੜੇ ਬੇਟਾ ਗਾ ਉਹਨਾਂ ਨੂੰ ਹੈ ਨਾ ਕਰਾਟੇ ਕਰੂਟੇ ਵੀ ਸਿੱਖ ਸਕਦੇ ਆ ਹੈ ਨਾ ਉਹਨਾਂ ਨੂੰ ਮਤਲਬ ਸਵੀਵਿੰਗ ਬਾਰਾ ਸਾਲ ਦਾ ਹੈ ਜੀ ਉਹਨਾਂ ਨੇ ਸਵੀਵਿੰਗ ਵੀ ਸਿੱਖਣੀ ਸੀਗੀ ਵੀ ਅਗਰ ਹਾਂਜੀ ਵੀ ਤੁਸੀਂ ਸਰ ਕਿਵੇਂ ਫੀਸ ਫੂਸ ਲੈਂਦੇ ਹੋ ਸਿਖਾ ਦੋਂਗੇ ਜੀ ਕਿਵੇਂ ਫੀਸ ਲੈਂਦੇ ਹੋ ਜੀ ਤੁਸੀਂ ਮਤਲਬ ਮੁੰਡੇ ਅਤੇ ਕੁੜੀ ਦੀ ਇੱਦਾਂ ਕੋਈ ਇਸਦਾ ਕੁੜੀ ਮੇਰੀ ਮਤਲਬ ਸਰ ਗਿਆਰਾ ਸਾਲ ਦੀ ਆ ਜੀ ਮਤਲਬ ਬੇਟਾ ਜਿਹੜਾ ਉਹ ਬਾਰਾਂ ਸਾਲ ਦਾ ਗਾ ਇੱਕ ਸਾਲ ਦਾ ਹੀ ਫ਼ਰਕ ਆ ਵੈਸੇ ਉਹਨਾਂ 'ਚ ਕਿੰਨਾ ਕੁ ਹਾਂਜੀ ਕਿੰਨਾ ਟਾਈਮ ਆ ਜੀ ਅੱਛਾ ਮੈਮ ਅਤੇ ਮੈਂ ਉਹ ਫਿਰ ਮੈਮ ਮੇਰੀ ਜਿਹੜੀ ਬੇਟੀ ਆ ਜੀ ਉਹ ਡਾਂਸ ਵਧੀਆ ਕਰ ਲੈਂਦੀ ਹੈਗੀ ਅਤੇ ਫਿਰ ਉਹਨਾਂ ਨੂੰ ਕਰਾਟੇ ਵੀ ਉਹ ਸਿੱਖ ਮਤਲਬ ਕਹਿੰਦੀ ਸੀ ਸਿੱਖਣ ਨੂੰ ਵੀ ਸਿੱਖ ਲਾਂਗੇ ਅਤੇ ਸਵੀਵਿੰਗ ਵੀ ਥੋੜ੍ਹੀ ਬਹੁਤੀ ਕਰ ਲੈਂਦੀ ਹੈਗੀ ਮਤਲਬ ਇੰਨੀ ਨਹੀਂ ਆਉਂਦੀ ਗੀ ਥੋੜ੍ਹੀ ਬਹੁਤੀ ਤਾਂ ਉਹ ਕਰ ਲੈਂਦੀ ਹੈਗੀ ਉਹ ਵੀ ਸਿਖਾ ਦਿਓ ਨਾਲ ਡਾਂਸ ਅਤੇ ਕਰਾਟੇ ਅਤੇ ਸਵੀਵਿੰਗ ਦੋਨਾਂ ਨੂੰ ਮਤਲਬ ਸਿਖਾਉਣਾ ਗਾ ਇਹ ਡਾਂਸ ਮਤਲਬ ਮੇਰਾ ਬੇਟਾ ਜਿਹੜਾ ਉਹ